ਹੈਲੋ ਦਕਸ਼ ਹਾਂਜੀ ਹਾਂਜੀ ਦਕਸ਼ ਹੋਰ ਸੁਣਾਓ ਕੀ ਹਾਲ ਚਾਲ ਬਸ ਆਇਆ ਨਹੀਂ ਅੱਜ ਕੋਲੇਜ ਅੱਛਾ ਯਾਰ ਮੈਂ ਤੁਹਾਨੂੰ ਜੋਬ ਬਾਰੇ ਪੁੱਛਣਾ ਸੀ ਕਿ ਜੋਬ ਦਾ ਕੀ ਹਿਸਾਬ ਕਿਤਾਬ ਹੈ ਹਾਂਜੀ ਕੋਲੇਜ ਜੋਬ ਦਾ

ਹਾਂ ਸਮਝ ਗਿਆ

ਚੱਲ ਠੀਕ ਹੈ ਮੈਂ ਵੀ ਫਿਰ ਮਿਹਨਤ ਕਰਨਾ ਸੀ ਲੈਂਗਏਜ਼ 'ਚ ਥੋੜ੍ਹਾ ਜਿਹਾ ਜਿਹੜੇ ਕੰਪਿਊਟਰ ਦੇ ਮਾੜੇ ਮੋਟੇ ਬੇਸਿਕ ਹੈ ਨਾ ਉਹਦੇ ਬਾਰੇ ਥੋੜ੍ਹਾ ਕੰਨਫਰਮੇਸ਼ਨ ਕਰਨਾ ਹੈ

ਹਾਂ ਹਾਂ ਉਹ ਤਾਂ ਫਿਰ ਇੰਟਰਨਸ਼ਿਪ ਵੀ ਲੱਗੇਗੀ ਨਾ

ਹਾਂ ਆਹੋ ਠੀਕ ਹੈ ਫਿਰ ਚਲੋ ਠੀਕ ਹੈ ਥੈਂਕ ਯੂ ਬਰੋ